ਪੰਜਾਬ ਦੇ ਲੋਕ ਬਹੁਤ ਹੀ ਖੁੱਲ੍ਹੇ ਡੁੱਲ੍ਹੇ ਸੁਭਾਅ ਦੇ ਮਾਲਕ ਹਨ ਉਹਨਾਂ ਦਾ ਮਨੋਰੰਜਨ ਕਰਨ ਦਾ ਤਰੀਕਾ ਬਹੁਤ ਹੀ ਵੱਖਰੇ ਤਰੀਕੇ ਵੱਖਰਾ ਹੁੰਦਾ ਹੈ ਉਹ ਆਪਣਾ ਦਿਲ ਖੋਲ੍ਹ ਕੇ ਮਨੋਰੰਜਨ ਕਰਦੇ ਹਨ ਜਿਵੇਂ ਕਿ ਨੱਚ ਟੱਪ ਕੇ ਗਾ ਕੇ ਜਾਂ ਬਾਹਰ ਘੁੰਮ ਫਿਰ ਕੇ ਨੌਜਵਾਨ ਤੋਂ ਲੈ ਕੇ ਬੁੜਾ ਬੁੱਢੇ ਲੋਕ ਵੀ ਮਨੋਰੰਜਨ ਕਰਦੇ ਹਨ ਕਿਉਂਕਿ ਉਹ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਵਿਅਕਤ ਕਰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਜੋ ਵੀ ਹੁੰਦਾ ਹੈ ਉਹ ਖੁੱਲ੍ਹ ਕੇ ਜਿਊਂਦੇ ਹਨ ਕੁਝ ਲੋਕ ਨੱਚਦੇ ਹਨ ਟੱਪਦੇ ਹਨ ਅਤੇ ਕੁਝ ਲੋਕ ਬਾਹਰ ਘੁੰਮਣਾ ਫਿਰਨਾ ਪਸੰਦ ਕਰਦੇ ਹਨ ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕ ਰਾਤ ਨੂੰ ਕਲੱਬਾਂ ਵਿੱਚ ਜਾਣਾ ਪਸੰਦ ਕਰਦੇ ਹਨ ਕੁਝ ਲੋਕ ਰਾਤ ਨੂੰ ਖਾਣ ਪੀਣ ਜਾਂਦੇ ਹਨ ਤਾਂ ਕਿ ਉਹ ਆਪਣੇ ਆਪ ਨੂੰ ਮਨੋਰੰਜਨ ਕਰ ਸਕਣ ਅਤੇ ਬਾਹਰ ਘੁੰਮ ਫਿਰ ਸਕਣ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਇੱਦਾਂ ਦੀਆਂ ਹਨ ਜਿੱਥੇ ਰਾਤ ਨੂੰ ਲੋਕ ਜਾ ਕੇ ਆਪਣਾ ਮਨੋਰੰਜਨ ਕਰਦੇ ਹਨ ਕੁਝ ਥਾਵਾਂ ਜਿਵੇਂ ਕਿ ਸਨਸਿਟੀ ਜਾਂ ਵੰਡਰਲੈਂਡ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਜਾ ਕੇ ਆਪਣਾ ਦਿਲ ਪਰਚਾਵਾ ਕਰਦੇ ਹਨ ਅਤੇ ਵੱਖ ਵੱਖ ਤਰੀਕੇ ਨਾਲ਼ ਮਨੋਰੰਜਨ ਕਰ ਸਕਦੇ ਹਨ ਰਾਤ ਨੂੰ ਕੁਛ ਲੋਕ ਖਾਣ ਪੀਣ ਜਾਂਦੇ ਹਨ ਤਾਂ ਕਿ ਉਹ ਵੱਖ ਵੱਖ ਤਰ੍ਹਾਂ ਦੀਆਂ ਡਿਸ਼ਾਂ ਨੂੰ ਖਾ ਕੇ ਵੱਖ ਵੱਖ ਤਰ੍ਹਾਂ ਨਾਲ਼ ਆਪਣਾ ਪਰਚਾਵਾ ਕਰ ਸਕਣ